ਰੂਪਨਗਰ ਜ਼ਿਲ੍ਹੇ ਦਾ ਮੌਸਮ ਬਹੁਤ ਵਧੀਆ ਹੈ ਜਿਵੇਂ ਥੋੜ੍ਹਾ ਜਿਹਾ ਵੀ ਤਾਪਮਾਨ ਵੱਧ ਜਾਵੇ ਤਾਂ ਰਾਤ ਨੂੰ ਜਾਂ ਦੂਜਾ ਦਿਨ ਵਰਖਾ ਹੋ ਜਾਂਦੀ ਹੈ ਹੋ ਜਾਂਦੀ ਹੈ ਇੱਥੇ ਮੌਸਮ ਖੁਸ਼ਕ ਖੁਸ਼ਕ ਮਿਜ਼ਾਜ਼ ਰਹਿੰਦਾ ਹੈ ਉਹ ਮੌਸ ਉਹ ਮੌਸਮ ਇਸ ਲਈ ਰਹਿੰਦਾ ਹੈ ਕਿ ਰੋਪੜ ਜ਼ਿਲ੍ਹੇ ਦੇ ਨਾਲ ਹਿਮਾਚਲ ਦੀਆਂ ਪਹਾੜੀਆਂ ਲੱਗਦੀਆਂ ਹਨ ਹਿਮਾਚਲ ਦਾ ਬੌਡਰ ਹੈ ਰੋਪੜ ਰੋਪੜ 'ਤੇ ਜੇ ਹਿਮਾਚਲ ਵਿੱਚ ਵੀ ਥੋੜ੍ਹਾ ਜਿਹਾ ਮੀਂਹ ਜਾਂ ਕੋਈ ਕਿਣੀਆਂ ਪੈਂ ਜਾਵੇ ਤਾਂ ਠੰਡੀ ਹਵਾ ਸਾਡੇ ਰੋਪੜ ਨੂੰ ਆਉਣ ਲੱਗ ਜ ਲੱਗ ਪੈਂਦੀ ਹੈ ਮੈਂ ਇਸ ਲਈ ਖੁਸ਼ਕ ਅਤੇ ਮਿਜ਼ਾਜ਼ ਕਿ ਮੌਸਮ ਨੂੰ ਕਿਹਾ ਹੈ ਹਾਂ ਸਾਡੇ ਇੱਥੇ ਗਰਮੀ ਜਿਹੜੀ ਜੋ ਮੈਂ ਦੇਖਿਆ ਹੈ ਗਰਮੀ ਸਾਡੇ ਦੋ ਸਾਲ ਪਹਿਲਾਂ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਟੈਪਰੇਚਰ ਛਿਆਲੀ ਡਿਗਰੀ ਤੱਕ ਵੀ ਸੀ ਪਰ ਜੇ ਅੱਜ ਦੇਖਾਂ ਦੇਖਿਆਂ ਜਾਵਾਂ ਅੱਜ ਸਾਡਾ ਜੋ ਅੱਜ ਦਾ ਪਿਛਲੇ ਮਹੀਨੇ ਦਾ ਟੈਪਰੇਚਰ ਆ ਉਹ ਚੌਂਤੀ ਡਿਗਰੀ ਰਿਹਾ ਹੈ ਇਸ ਕਰਕੇ ਮੌਸਮ ਵਿੱਚ ਬਹੁਤ ਗਿਰਾਵਟ ਆਈ ਹੈ ਅਨੂ ਮੇਰੀ ਜ਼ਿੰਦਗੀ ਦਾ ਜੋ ਮੌਸਮ ਵਿੱਚ ਤਬਦੀਲੀ ਮੈਂ ਦੇਖੀ ਹੈ ਸਾਡੇ ਇੱਥੇ ਦੋ ਹਜ਼ਾਰ ਉੱਨੀ ਵਿੱਚ ਉੱਨੀ ਵਿੱਚ ਇੱਕ ਹਫ਼ਤਾ ਲਗਾਤਾਰ ਮੀਂਹ ਪੈਣ ਨਾਲ ਸਾਡੇ ਇੱਥੇ ਹੜ੍ਹ ਆ ਗਏ ਸਨ ਹੜ੍ਹ ਮਤਲਬ ਸਾਡੇ ਨਾਲ ਸਤ ਮਤਲਬ ਰੋਪੜ ਦੇ ਨਾਲ ਸਤਲੁਜ ਦਰਿਆਂ ਲੱਗਦਾ ਹੈ ਅਤੇ ਨਦੀਆਂ ਨਾਲੇ ਬਹੁਤ ਹਨ ਹਿਮਾਚਲ ਵਿੱਚ ਜਿੰਨੇ ਵੀ ਹਿਮਾਚਲ ਵਿੱਚੋਂ ਅ ਨਦੀਆਂ ਨਿਕਲਦੀਆਂ ਹਨ ਉਹ ਸਾਡੇ ਰੋਪੜ ਰੋਪੜ ਸਤਲੁਜ ਦਰਿਆ ਵਿੱਚ ਹੀ ਡਿੱਗਦੀਆਂ ਹਨ ਮੀਂਹ ਹਫ਼ਤਾ ਨਹੀਂ ਹ ਹਫ਼ ਨਹੀਂ ਪੂਰਾ ਇੱਕ ਹਫ਼ਤਾ ਨਹੀਂ ਹੱਟਿਆ ਨਦੀਆਂ ਵਿੱਚ ਪਾਣੀ ਇੰਨਾਂ ਆ ਗਿਆ ਸਾਡੇ ਮੈਂ ਮੈਨੂੰ ਯਾਦ ਆ ਸਾਡੇ ਪਿੰਡ ਤੋਂ ਨਾਲ ਹੀ ਇੱਥੇ ਫ ਖਹਿਰਾਬਾਦ ਪਿੰਡ ਆ ਉੱਥੋਂ ਨਦੀ ਟੁੱਟ ਗਈ ਜਿਸ ਨਾਲ ਕਿ ਸਾਡੇ ਇੱਥੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਜੋ ਨੀਂਵੇ ਪਿੰਡ ਸੀ ਖਹਿਰਾਬਾਦ ਲਾ ਲਉ ਫੂਲ ਖੁਰਦ ਲਾ ਲਉ ਆਪਣਾ ਸੁਰਤਾਪੁਰ ਲਾ ਲਉ ਅਤੇ ਸਾਡੀ ਇੱਥੇ ਨਵੀਂ ਆਈ ਆਈ ਟੀ ਬਣੀ ਹੈ ਉਸ ਵਿੱਚ ਵੀ ਤੁਸੀਂ ਮੰਨੋਗੇ ਦਸ ਦਸ ਫੁੱਟ ਪਾਣੀ ਚੜ੍ਹ ਗਿਆ ਸੀ ਇਹ ਤਬਦੀਲੀ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਣ ਨੂੰ ਮੈਨੂੰ ਮਿਲੀ ਸੀ